ਭਾਰਤ ਤੋਂ ਬਾਹਰ ਸਰਫਿੰਗ ਕਰਨ ਦਾ ਸਭ ਤੋਂ ਵਧੀਆ ਸ੍ਰੀ ਲੰਕਾ ਅਤੇ ਬੈਂਕੋਂਕ ਹੈ ਜੋ ਕਿ ਸਮੁੰਦਰ ਦੇ ਨਾਲ ਲੱਗਦੇ ਦੇਸ਼ ਹਨ ਮੈਂ ਜ਼ਿਆਦਾਤਰ ਜਿਹੜੀ ਸਰਫਿੰਗ ਹੈ ਉਹ ਸਮੁੰਦਰ ਦੇ ਕੰਢੇ ਕੀਤੀ ਹੈ ਜਿੱਥੇ ਲਹਿਰਾਂ ਦੀ ਸਪੀਡ ਜ਼ਿਆਦਾ ਹੁੰਦੀ ਹੈ ਇਸ ਲਈ ਸਰਫਿੰਗ ਵਿੱਚ ਆਸਾਨੀ ਹੁੰਦੀ ਹੈ ਧੰਨਵਾਦ ਜੀ